ਵੀਡੀਓ ਗੇਮ ਮੈਂ ਬਚਪਨ ਵਿੱਚ ਬੜੀਆਂ ਗੇਮਾਂ ਖੇਡੀਆਂ ਛੋਟੀਆਂ ਛੋਟੀਆਂ ਵੀਡੀਓ ਗੇਮਾਂ ਜਿਵੇਂ ਪੁਰਾਣੀਆਂ ਖੇਡਦੇ ਹੁੰਦੇ ਸੀ ਉਹ ਵੀਡੀਓ ਗੇਮ ਜਿਹੜੀ ਇੱਕ ਰਮੋਟ ਹੁੰਦਾ ਸੀ ਅਤੇ ਉਹ ਵਾਲੀਆਂ ਗੇਮਾਂ ਬਹੁਤ ਸਾਰੀਆਂ ਗੇਮਾਂ ਖੇਡੀਆਂ ਮੈਂ ਮਾਰੀਓ ਹੋ ਗਈਆਂ ਜਿਵੇਂ ਕਿ ਉਹ ਕਾਊਂਟਰਾ ਹੋ ਗਈ ਸਾਰਿਆਂ ਨਾਲੋਂ ਜ਼ਿਆਦਾ ਖੇਡਦਾ ਹੁੰਦਾ ਸੀ ਮੈਂ ਕਾਊਂਟਰਾ ਉਹਦੇ ਵਿੱਚ ਜਿਹੜੇ ਫੋਜੀ ਹੁੰਦੇ ਸੀ ਛੋਟੇ ਹੁੰਦੇ ਸੀ ਉਦੋਂ ਫੋਜੀ ਹੁੰਦੇ ਸੀਗੇ ਉਹਨਾਂ ਨੂੰ ਫੋਜੀ ਮਾਰਦਾ ਉਨ੍ਹਾਂ ਨੂੰ ਗੋਲੀਆਂ ਪਾਵਰਾਂ ਲੈਣੀਆਂ ਬਹੁਤ ਵਧੀਆ ਲੱਗਦੀਆਂ ਹੁੰਦੀਆਂ ਸੀ ਮੈਨੂੰ ਸਾਰੀਆਂ ਗੇਮਾਂ